ਭਾਰਤ ਦੀਆਂ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਸਾਇਕਲ 'ਤੇ ਨਹੀਂ ਜਾਇਆ ਜਾ ਸਕਦਾ ਮੈਂ ਆਪਣੇ ਦੋਸਤਾਂ ਨਾਲ ਮੋਟਰਸਾਈਕਲ 'ਤੇ ਜ਼ਰੂਰ ਗਿਆ ਹਾਂ ਜਿਵੇਂ ਕਿ ਫਤਿਹਗੜ੍ਹ ਸਾਹਿਬ ਮੈਂ ਇਤਿਹਾਸਿਕ ਜਗ੍ਹਾ 'ਤੇ ਸਾਈਕਲ 'ਤੇ ਗਿਆ ਹਾਂ ਉੱਥੇ ਮੈਂ ਬਹੁਤ ਵਾਰ ਸਾਈਕਲ 'ਤੇ ਗਿਆ ਹਾਂ ਉੱਥੇ ਸ਼ਹੀਦੀ ਜੋੜ ਮੇਲਾ ਦੌਰਾਨ ਅਸੀਂ ਸਾਈਕਲਾਂ 'ਤੇ ਕਾਫੀ ਵਾਰ ਗਏ ਸੀ ਇਵੇਂ ਹੁਣ ਅੱਜ ਕੱਲ੍ਹ ਸਾਈਕਲਾਂ ਦਾ ਜ਼ਮਾਨਾ ਕਾਫੀ ਅਲੋਪ ਹੋ ਗਿਆ ਹੈ ਸਾਡੇ ਘਰ ਅੱਜ ਵੀ ਸਾਈਕਲ ਹੈ ਜਿਸ ਜਿਸ 'ਤੇ ਅਸੀਂ ਸਵੇਰੇ ਸੈਰ ਕਰਨ ਲਈ ਕਈ ਵਾਰ ਜਾਂਦੇ ਹਾਂ